ਪੰਜਾਬ ਦਾ ਇੱਕ ਪਰੰਪਰਾਗਤ ਲੋਕ ਨਾਚ ਭੰਗੜਾ ਜਿਹੜਾ ਕਿ ਸਾਰੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਮਸ਼ਹੂਰ ਹੈ ਅਤੇ ਭੰਗੜਾ ਜਿਹੜਾ ਇਹਦੇ ਬਾਰੇ ਲੋਕਾਂ ਨੇ ਗਲਤ ਧਾਰਨਾਵਾਂ ਬਣਾਈਆਂ ਹੋਈਆਂ ਜਦਕਿ ਇੱਦਾਂ ਨਹੀਂ ਹੈ ਭੰਗੜਾ ਜਿਹੜਾ ਇਹ ਆਪਣੀ ਖੁਸ਼ੀ ਦਾ ਇੱਕ ਪ੍ਰਗਟਾਵਾ ਹੈ ਕੋਈ ਵੀ ਬੱਚੇ ਦੇ ਜਨਮ ਤੋਂ ਲੈ ਕੇ ਵਿਆਹ ਤੱਕ ਭੰਗੜੇ ਦੇ ਨਾਲ ਅਸੀਂ ਆਪਣੀ ਖੁਸ਼ੀ ਜ਼ਾਹਰ ਕਰ ਸਕਦੇ ਹਾਂ ਇਹਦੇ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਨੇ ਇਹ ਭਾਰ ਘਟਾਉਣ ਦੇ ਵਿੱਚ ਜਿੱਦਾਂ ਸਰੀਰ ਇਹਦੇ 'ਚ ਤੰਦਰੁਸਤ ਰਹਿੰਦਾ ਆ ਜਦੋਂ ਅਸੀਂ ਭੰਗੜਾ ਪਾਉਂਦੇ ਹਾਂ ਤਾਂ ਸਾਡੇ ਸਰੀਰ ਦੇ ਹਰ ਹਿੱਸੇ ਨੂੰ ਇੱਕ ਨਵੀਂ ਤਾਕਤ ਮਿਲਦੀ ਹੈ ਅਤੇ ਲੋਕਾਂ ਨੇ ਸਿਰਫ ਗਲਤ ਧਾਰਨਾਵਾਂ ਇਸ ਲਈ ਬਣਾਈਆਂ ਹੋਈਆਂ ਕਿ ਲੋਕ ਇਹ ਸੋਚਦੇ ਆ ਇਹਦੇ ਵਿੱਚ ਸ਼ੋਰ ਸ਼ਰਾਬਾ ਹੈ ਚੀਕ ਚਿਹਾੜਾ ਹੈ ਜਦੋਂ ਢੋਲ ਵੱਜਦਾ ਹੈ ਤਾਂ ਲੋਕ ਕਹਿੰਦੇ ਆ ਕਿ ਇਹ ਨਹੀਂ ਠੀਕ ਹੈ ਇਹਦੇ ਨਾਲ ਬਹੁਤ ਖੱਪ ਪੈਂਦੀ ਹੈ ਅਤੇ ਭੰਗੜੇ ਦੇ ਵਿੱਚ ਜਿਹੜੀਆਂ ਬੋਲੀਆਂ ਵਰਤੀਆਂ ਜਾਂਦੀਆਂ ਉਹ ਸਾਡੇ ਜਿਹੜੀ ਇੱਕ ਅੰਦਰੂਨੀ ਖੁਸ਼ੀ ਹੁੰਦੀ ਹੈ ਉਹ ਅਸੀਂ ਬੋਲੀਆਂ ਦੇ ਰਾਹੀਂ ਮਤਲਬ ਕਿ ਪੇਸ਼ ਕਰਦੇ ਹਾਂ ਅਤੇ ਇਹਨਾਂ ਨੂੰ ਮਤਲਬ ਕਿ ਮੈਂ ਤਾਂ ਇਹ ਕਹਿੰਦੀ ਹਾਂ ਕਿ ਇਹਨਾਂ ਦਾ ਹੱਲ ਅਸੀਂ ਇੱਦਾਂ ਕਿ ਲੋਕਾਂ ਨੂੰ ਆਪਾਂ ਇਹਦੇ ਬਾਰੇ ਦੱਸ ਸਕੀਏ ਭੰਗੜਾ ਮਤਲਬ ਭੰਗੜਾ ਹ ਇਹਦੇ ਲਈ ਮਤਲਬ ਕਿ ਇਹਨਾਂ ਦੀਆਂ ਧਾਰਾਵਾਂ ਜਿਹੜੀਆਂ ਗਲਤ ਬਣੀਆਂ ਹੋਈਆਂ ਉਹਨੂੰ ਇਹ ਦੱਸਣ ਦੇ ਲਈ ਚਾਹੇ ਸਾਨੂੰ ਚਾਹੀਦਾ ਕਿ ਇਹਦੇ ਬਾਰੇ ਅਸੀਂ ਮਤਲਬ ਕਿ ਹਰ ਇੱਕ ਨੂੰ ਇਹਦੇ ਬਾਰੇ ਆਪਾਂ ਵਧੀਆ ਤੋਂ ਵਧੀਆ ਦੱਸੀਏ ਕਿ ਭੰਗੜਾ ਜਿਹੜਾ ਹੈ ਇਹ ਇੱਕ ਖੁਸ਼ੀ ਜ਼ਾਹਰ ਕਰਨ ਦਾ ਇੱਕ ਲੋਕ ਨਾਚ ਹੈ ਇਹਦੇ ਵਿੱਚ ਜਦੋਂ ਅਸੀਂ ਭੰਗੜੇ ਵਾ ਭੰਗੜਾ ਪਾਉਂਦੇ ਹਾਂ ਤਾਂ ਸਾਡੇ ਸਰੀਰਕ ਤੌਰ 'ਤੇ ਮਾਨਸਿਕ ਤੌਰ 'ਤੇ ਬੜੀ ਤ ਮਤਲਬ ਸੰਤੁਸ਼ਟੀ ਮਿਲਦੀ ਹੈ ਇੱਕ ਖੁਸ਼ ਹੋ ਜਾਂਦੇ ਹਾਂ ਸਾਰੇ ਤਣਾਅ ਮੁਕਤ ਹੋ ਜਾਂਦੇ ਹਾਂ ਮਤਲਬ ਮੈਨੂੰ ਤਾਂ ਲੱਗਦਾ ਕਿ ਇਹ ਇੱਕ ਬਹੁਤ ਵਧੀਆ ਲੋਕ ਨਾਚ ਹੈ